ਯੋਗਾ ਦਾ ਅਭਿਆਸ ਕਰਨ ਤੋਂ ਬਾਅਦ ਸਾਨੂੰ ਇਹ ਲਾਭ ਮਿਲਦੇ ਹਨ ਕਿ ਅਸੀਂ ਸਰੀਰ ਵੀ ਸਾਡਾ ਤਜੋ ਤਰੋ ਤਾਜ਼ਾ ਰਹਿੰਦਾ ਹੈ ਅਤੇ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ ਕਈ ਤਰ੍ਹਾਂ ਦੇ ਸਾਡੇ ਅੰਦਰ ਵਿਟਾਮਿਨ ਬਣਦੇ ਹਨ ਅਤੇ ਸਰੀਰ ਸਾਡਾ ਚੁਸਤ ਰਹਿੰਦਾ ਹੈ ਦਿਮਾਗ ਇਕਦਮ ਫਰੈਸ਼ ਤਾਜ਼ਾ ਰਹਿੰਦਾ ਹੈ ਅਤੇ ਪੜ੍ਹਨ ਵਾਲੇ ਬੱਚਿਆਂ ਦਾ ਜਿਸ ਤਰ੍ਹਾਂ ਦਿਮਾਗ ਕਿ ਇੱਕਦਮ ਤਾਜ਼ਾ ਕਿ ਜੋ ਵੀ ਪੜ੍ਹਾਈ ਕਰਦੇ ਆ ਦਿਮਾਗ 'ਚ ਬੈਠਦੀ ਹੈ ਅਤੇ ਇਸ ਕਰਕੇ ਮਤਲਬ ਕਿ ਯੋਗਾ ਅਭਿਆਸ ਕਰਨ ਤੋਂ ਸਾਨੂੰ ਇਹ ਬਹੁਤ ਫਾਇਦੇ ਮਿਲਦੇ ਹਨ ਅਤੇ ਅਸੀਂ ਕਈ ਬਿਮਾਰੀਆਂ ਨੂੰ ਵੀ ਦੂਰ ਰੱਖਦੇ ਹਾਂ ਆਪਣਾ ਸਰੀਰ ਚੁਸਤ ਫੁਰਤ ਰਹਿੰਦਾ ਹੈ ਸਾਡਾ ਅਤੇ ਅਸੀਂ ਮਤਲਬ ਕਿ ਵੀ ਐਕਟਿਵ ਰਹਿੰਦੇ ਹਾਂ ਇਸ ਕਰਕੇ ਪੜ੍ਹਾਈ ਵਾਲੇ ਬੱਚਿਆਂ ਲਈ ਤਾਂ ਇਹ ਬਹੁਤ ਵਧੀਆ ਹੈ ਅਤੇ ਹਮੇਸ਼ਾ ਬੰਦਾ ਤਰੋ ਤਾਜ਼ਾ ਬਣਿਆ ਰਹਿੰਦਾ ਹੈ ਬਿਮਾਰੀਆਂ ਤੋਂ ਵੀ ਦੂਰ ਰਹਿੰਦਾ ਹੈ